ਮੇਰਾ ਸਭ ਤੋਂ ਯਾਦਗਾਰ ਡਾਂਸ ਪ੍ਰਦਰਸ਼ਨ ਉਦੋਂ ਰਿਹਾ ਸੀ ਜਦੋਂ ਕਿ ਸਾਡੇ ਸ਼ਹਿਰ ਵਿੱਚ ਇੱਕ ਡਾਂਸ ਸ਼ੋ ਲੱਗਿਆ ਸੀ ਜਿੱਥੇ ਵੱਖ ਵੱਖ ਲੋਕ ਕੋਂਟੈਸਟ ਕਰ ਰਹੇ ਸੀ ਅਤੇ ਉਹਨਾਂ ਨੇ ਪਾਰਟੀਸੀਪੇਟ ਕੀਤਾ ਸੀ ਅਤੇ ਉਸ ਵਿੱਚ ਇੱਕ ਪਾਰਟੀਸੀਪੇ ਮੈਂ ਵੀ ਕੀਤਾ ਸੀ ਅਤੇ ਉਸ ਵਿੱਚ ਮੈਨੂੰ ਹਾਲੇ ਤੱਕ ਯਾਦ ਹੈ ਉਸ ਵਿੱਚ ਮੈਨੂੰ ਹਾਲੇ ਵੀ ਫਸਟ ਪ੍ਰਾਈਜ ਮਿਲਿਆ ਸੀ

ਮੈਨੂੰ ਅਵਾਰਡ ਵੀ ਦਿੱਤਾ ਗਿਆ ਸੀ ਪਾਰਟੀਸੀਪੇਸ਼ਨ ਦਾ ਅਤੇ ਫਸਟ ਪ੍ਰਾਈਜ ਦਾ ਅਲੱਗ ਅਵਾਰਡ ਸੀ ਅਤੇ ਉਸ ਵੇਲੇ ਮੈਨੂੰ ਕੈਸ਼ ਪ੍ਰਾਈਜ਼ ਮਿਲਿਆ ਸੀ ਪੰਜ ਹਜ਼ਾਰ ਰੁਪਏ ਅਤੇ ਉਹ ਮੂਮੈਂਟ ਮੇਰੇ ਲਈ ਬਹੁਤ ਯਾਦਗਾਰ ਰਿਹਾ ਸੀ ਅਤੇ ਮੇਰੇ ਮਾਪੇ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ ਸੀ ਉਸ ਵਿੱਚ ਕਈ ਲੋਕਾਂ ਨੇ ਪਾਰਟੀਸੀਪੇਟ ਕੀਤਾ ਸੀ ਬਟ ਮੈਂ ਫਸਟ ਆਈ ਸੀ ਅਤੇ ਮੇਰੇ ਮਾਪੇ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ ਸਨ ਇਹ ਮੇਰਾ ਇੱਕ ਯਾਦਗਾਰ ਡਾਂਸ ਪ੍ਰਦਰਸ਼ਨ ਸੀ ਅਤੇ ਮੇਰਾ ਦੂਜਾ ਡਾਂਸਗਰ ਡਾਂਸ ਪ੍ਰਦਰਸ਼ਨ ਇਹ ਸੀ ਜਦੋਂ ਬਾਰਵੀਂ ਦੀ ਫੇਅਰਵੈਲ ਹੋਈ ਸੀ ਅਤੇ ਉਸ ਵਿੱਚ ਮੈਂ ਅਤੇ ਮੇਰੇ ਸਾ ਮੈਂ ਅਤੇ ਮੇਰੇ ਸਾਥੀ ਨੇ ਡਾਂਸ ਕੀਤਾ ਸੀ ਉਹ ਮੂਮਮੈਂਟ ਵੀ ਮੇਰੇ ਲਈ ਬਹੁਤ ਯਾਦਗਾਰ ਰਿਹਾ ਸੀ ਉਹ ਇੱਦਾਂ ਦਾ ਮੂਮੈਂਟ ਸੀ ਕਿ ਉਹ ਮੈਂ ਮੇਰੇ ਮੇਰੇ ਨਾਲ ਹੀ ਉਹਨੇ ਪਰਫੋਰਮ ਕੀਤਾ ਸੀ ਅਤੇ ਉਹ ਮੇਰੀ ਸਭ ਤੋਂ ਯਾਦਗਾਰ ਡਾਂਸ ਪਰਫੋਰਮੈਂਸ ਸੀਗੀ ਉਸ ਪਰਫੋਰਮੈਂਸ ਵਿੱਚ ਸਾਰੇ ਸਕੂਲ ਵਾਲਿਆਂ ਨੇ ਅਤੇ ਟੀਚਰਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਸੀ ਈਵਨ ਕਿ ਉਹ ਖੁਦ ਨੱਚ ਪਏ ਸੀ ਆਪਣੀ ਸੀਟਾਂ ਤੋਂ ਉੱਠ ਕੇ ਅਤੇ ਉਹਨਾਂ ਨੇ ਬਹੁਤ ਐਪਰੀਸ਼ ਸੀਏਟ ਕੀਤਾ ਸੀ ਮੈਨੂੰ ਮੈਂ ਉਸ ਦਿਨ ਬਹੁਤ ਖੁਸ਼ ਹੋਈ ਸੀ ਉਹ ਮੂਮੈਂਟ ਮੈਂ ਕਦੇ ਨਹੀਂ ਭੁੱਲ ਸਕਦੀ ਅਤੇ ਮੈਨੂੰ ਇਹ ਦੋ ਮੁਮੈਂਟ ਮੇਰੇ ਸਭ ਤੋਂ ਯਾਦਗਾਰ ਹਨ ਬਾਕੀ ਵੀ ਮੇਰੇ ਸਾਥੀਦਾਰਾਂ ਨੇ ਪ੍ਰਫੋਮ ਸੀ ਕੀਤਾ ਸੀ ਬਟ ਸਭ ਤੋਂ ਜ਼ਿਆਦਾ ਅਤੇ ਵਧੀਆ ਡਾਂਸ ਸਾਡਾ ਹੀ ਸੀ ਜੋ ਕਿ ਅਸੀਂ ਪ੍ਰਫੋਰਮ ਕੀਤਾ ਸੀ ਮੈਂ ਅਤੇ ਮੇਰੀ ਸਾਥੀਦਾਰ ਨੇ ਸਾਰੇ ਲੋਕਾਂ ਨੇ ਕਿਹਾ ਸੀ ਉਹ ਬਹੁਤ ਵਧੀਆ ਡਾਂਸ ਸੀਗਾ ਅਤੇ ਅਸੀਂ ਉਸ ਟਾਈਮ ਬਹੁਤ ਖੁਸ਼ ਹੋਏ ਸੀ